ਜਾਨਵਰਾਂ ਦੇ ਡੰਗਾਂ ਤੋਂ ਸੁਰੱਖਿਅਤ ਰਹਿਣ ਲਈ ਕੁਝ ਤਰੀਕੇ ਹਨ ਜਿਨਾਂ ਤੋਂ ਅਸੀਂ ਆਪਣਾ ਅਤੇ ਲੋਕਾਂ ਦਾ ਬਚਾਅ ਕਰ ਸਕਦੇ ਹਾਂ ਜਿਵੇਂ ਕੀ ਕੁੱਤੇ ਦੇ ਕੱਟਣ ਨਾਲ ਸਾਨੂੰ ਟੀਕੇ ਲਗਵਾਉਣੇ ਚਾਹੀਦੇ ਹਨ ਅਤੇ ਸੱਪ ਲੜਨ ਤੋਂ ਬਾਅਦ ਸਾਨੂੰ ਜਲਦੀ ਤੋਂ ਜਲਦੀ ਡਾਕਟਰ ਕੋਲ ਜਾਣਾ ਚਾਹੀਦਾ ਹੈ ਤਾਂ ਜੋ ਡਾਕਟਰ ਤੋਂ ਦਵਾਈ ਲੈ ਕੇ ਆਪਣੀ ਸਹਾਇਤਾ ਕਰ ਸਕੀਏ